ਖੇਡਾਂ ਜਿੱਥੇ ਸਾਨੂੰ ਖੁਸ਼ੀ ਦਿੰਦੀਆਂ ਉੱਥੇ ਸਾਨੂੰ ਮਾਨਸਿਕ ਤੌਰ 'ਤੇ ਔਰ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਬਣਾਉਂਦੀਆਂ ਔਰ ਬੰਦਾ ਸਟਰੈੱਸ ਰਹਿਤ ਹੋ ਜਾਂਦਾ ਜਦੋਂ ਖੇਡਦਾ ਗਰਮੀ ਆ ਜਾਂਦੀ ਪੂਰੀ ਸਰੀਰ ਨੂੰ ਅਤੇ ਟੀਮ ਵਰਕ ਦੇ ਵਿੱਚ ਇੱਕ ਗੇਮ ਦੇ ਵਿੱਚ ਬਾਕੀ ਖਿਡਾਰੀਆਂ ਨਾਲ ਮਿਲ ਕੇ ਬੜਾ ਆਨੰਦ ਵੀ ਆਉਂਦਾ ਔਰ ਜਿੱਥੇ ਸਰੀਰ ਸਾਡਾ ਪਸੀਨਾ ਕੱਢਦਾ ਉਹਦੇ ਨਾਲ਼ ਸਾਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਆ ਔਰ ਸਾਡਾ ਸਰੀਰ ਜਿਹੜਾ ਉਹ ਤੰਦਰੁਸਤੀ ਵੱਲ ਨੂੰ ਵੱਧਦਾ ਜੇ ਮਨ ਦੇ ਵਿੱਚ ਸਾਡੇ ਕੋਈ ਦਿਮਾਗ 'ਤੇ ਕੋਈ ਸਟਰੈੱਸ ਵੀ ਹੈ ਉਹ ਖੇਡਣ ਦੇ ਨਾਲ਼ ਸਾਡੀ ਸਾਰੀ ਸੈਟਰੈੱਸ ਦੂਰ ਹੋ ਜਾਂਦੀ ਹੈ ਅਤੇ ਘਰ ਆ ਕੇ ਵੀ ਅਸੀਂ ਆਪਣੇ ਆਪ ਨੂੰ ਬੜਾ ਆਨੰਦਤ ਮਹਿਸੂਸ ਕਰਦੇ ਹਾਂ ਕਿ ਅਸੀਂ ਅੱਜ ਖੇਡ ਕੇ ਆਏ ਹਾਂ ਔਰ ਜਿੱਥੇ ਅਸੀਂ ਆਪਣੇ ਸਰੀਰ ਲਈ ਇਹ ਆਨੰਦਦਾਇਕ ਸਮਝਦੇ ਹਾਂ ਉੱਥੇ ਬਾਕੀ ਪਰਿਵਾਰ ਨੂੰ ਵੀ ਇਹ ਤੋਂ ਬੜੀ ਸੇਧ ਮਿਲਦੀ ਹੈ ਕਿ ਅੱਜ ਸਾਡੇ ਪਾਪਾ ਖੇਡ ਕੇ ਆਏ ਆ ਸਾਡੇ ਭਰਾ ਖੇਡ ਕੇ ਆਏ ਆ ਉਹਨਾਂ ਦੇ ਨਾਲ਼ ਜਿੱਥੇ ਸਾਨੂੰ ਆਪਾਂ ਨੂੰ ਆਪਣੇ ਆਪ ਨੂੰ ਐਨਰਜੀ ਮਿਲਦੀ ਹੈ ਉੱਥੇ ਦੂਸਰੇ ਲੋਕਾਂ ਨੂੰ ਵੀ ਅਸੀਂ ਐਨਰਜੀ ਦਿੰਦੇ ਹਾਂ ਔਰ ਇਹ ਗੇਮਾਂ ਦੇ ਵਿੱਚ ਸਾਨੂੰ ਸੇਧ ਮਿਲਦੀ ਹੈ ਕਿ ਅਸੀਂ ਕਿਵੇਂ ਮਿਲ ਜੁਲ ਕੇ ਜਿਵੇਂ ਖੇਡਾਂ ਦੇ ਵਿੱਚ ਖੇਡਦੇ ਹਾਂ ਇੱਕ ਲੁੱਕ ਦੂਜੇ ਦੇ ਸਹਿਯੋਗ ਦੇ ਨਾਲ਼ ਉਵੇਂ ਸਮਾਜ ਦੇ ਵਿੱਚ ਵੀ ਸਾਨੂੰ ਸਟਰੈੱਸ ਰਹਿਣ ਵਾਸਤੇ ਔਰ ਆਨੰਦ ਲੈਣ ਵਾਸਤੇ ਖੇਡਾਂ ਦਾ ਸਹਾਰਾ ਲੈਣਾ ਚਾਹੀਦਾ ਹੈ